ਮੇਰਾ ਜਿਹੜਾ ਪਹਿਲਾ ਪ੍ਰੋਡਕਟ ਸੀਗਾ ਜਿਹੜਾ ਮੈਂ ਖਰੀਦਿਆ ਸੀ ਉਹ ਹੈਗਾ ਵਾ ਵੀਵੋ ਐਕਸ ਹੰਡਰਡ ਇੱਕ ਮੋਬਾਈਲ ਫੋਨ ਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਆ ਉਹਦੀ ਸਪੈਸੀਫਿਕੇਸ਼ਨਸ ਪ੍ਰਫੋਮੈਸ ਕੈਮਰਾ ਜੋ ਕੁਝ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਉਹਦੇ ਵਿੱਚ ਇੱਕ ਇੰਚੀ ਦਾ ਸੈਂਸਰ ਆਉਂਦਾ ਵਾ ਫਿਫਟੀ ਮੈਗਾ ਪਿਕਸਲ ਅਲਟਰਾ ਵਾਈਡ ਹੁੰਦਾ ਆ ਅਤੇ ਪੈਰੀਸਕੋਪ ਸੈਂਸਰ ਵੀ ਹੁੰਦਾ ਵਾ ਫਿਫਟੀ ਮੈਗਾ ਪਿਕਸਲ ਦਾ ਜਿਹੜਾ ਕਿ ਫੋਰ ਕੇ ਰਿਕੋਡਿੰਗ ਕਰਦਾ ਆ ਮੈਂ ਹੁਣ ਆਪਣੇ ਦੋਸਤਾਂ ਦੀ ਰਿਸ਼ਤੇਦਾਰਾਂ ਦੀ ਵਿਆਹਾਂ ਸ਼ਾਦੀਆਂ 'ਚ ਜਾਂਦਾ ਵਾ ਉੱਥੇ ਇਹਦਾ ਕੈਮਰਾ ਬਹੁਤ ਹੀ ਜ਼ਿਆਦਾ ਵਧੀਆ ਪਰਫੋਰਮੈਂਸ ਦਿੰਦਾ ਵਾ ਜੋ ਕਿ ਬਹੁਤ ਸੋਣੀਆਂ ਫੋਟੋਸ ਵੀਡੀਓਸ ਕੈਪਚਰ ਕਰਦਾ ਆ ਅਤੇ ਇਕ ਇਹਦਾ ਪ੍ਰੋਸੈਸਰ ਜੋ ਕਿ ਮੀਡੀਆ ਟੈਕ ਡਮੈਸਟੀ ਨਾਈਨ ਥ੍ਰੀ ਹੰਡਰਡ ਹੈਗਾ ਆ ਜੋ ਕਿ ਬਹੁਤ ਹੀ ਜ਼ਿਆਦਾ ਪਾਵਰਫੁਲ ਪ੍ਰੋਸੈਸਰ ਆ ਇਹਦੇ ਵਿੱਚ ਪਬਜੀ ਬੀ ਜੀ ਐਮ ਆਈ ਵ ਜਿੰਨੀਆਂ ਗੇਮਸ ਹੈਗੀਆਂ ਬਹੁਤ ਹੀ ਸਮੂਥਲੀ ਚੱਲਦੀਆਂ ਵਾ ਇਹ ਵਾਲਾ ਫੋਨ ਫਾਈਵ ਜੀ ਕਨੈਟੀਵਿਟੀ ਨਾਲ ਆਉਂਦਾ ਵਾ ਤੇਰਾਂ ਫਾਈਵ ਜੀ ਬੈਂਡ ਆਉਂਦੇ ਆ ਵਾਈਫਾਈ ਸੈਵਨ ਆਉਂਦਾ ਆ ਅਤੇ ਇੱਕ ਇਹ ਫੋਨ ਚੱਲਣ 'ਚੋਂ ਵੀ ਬਹੁਤ ਹੀ ਜ਼ਿਆਦਾ ਸਮੂਥ ਆ ਇਹਦੇ ਵਿੱਚ ਇਹ ਸਟੋਰੇਜ ਮਾ ਸੋਲ੍ਹਾਂ ਜੀ ਬੀ ਰੈਮ ਆਉਂਦੀ ਆ ਪੰਜ ਸੌ ਬਾਰਾਂ ਜੀ ਬੀ ਰੋਮ ਇਹਦੀ ਜੋ ਕਿ ਇਹਦੀ ਸਟੋਰੇਜ ਭਰਦੀ ਹੀ ਨਹੀਂ ਜਿੰਨੀ ਮਰਜ਼ੀ ਫੋਟੋਜ਼ ਵੀਡੀਓਜ਼ ਸਟੋਰ ਕਰ ਲਵਾਂ ਬਹੁਤ ਹੀ ਜ਼ਿਆਦਾ ਵਧੀਆ ਫੋਨ ਆ ਅਤੇ ਇਹਦੇ ਵਿੱਚ ਆਈ ਆਰ ਬਲਾਸਟਰ ਵੀ ਆਉਂਦਾ ਆ ਜਿਹਦੇ ਨਾਲ ਕਿ ਮੈਂ ਕਿਸੇ ਵੀ ਇਸ ਚੀਜ਼ ਜਾਂ ਟੀ ਵੀ ਨੂੰ ਆਪਦੇ ਫੋਨ ਤੋਂ ਹੀ ਮੈਂ ਬੜੇ ਹੀ ਆਰਾਮ ਨਾਲ ਕੰਟਰੋਲ ਕਰ ਸਕਦਾ ਆਂ ਅਤੇ ਇੱਕ ਇਸ ਫੋਨ ਦੇ ਵਿੱਚ ਐਸ ਡੀ ਆਰ ਰਿਕੋ ਇਹਦੀ ਡਿਸਪਲੇ ਵੀ ਬਹੁਤ ਵਧੀਆ ਆ ਜਿਹੇ ਵਿੱਚ ਕਿ ਮੈਂ ਐਸ ਡੀ ਆਰ ਕੋਂਟੈਕਟ ਦੇਖ ਸਕਦਾ ਹਾਂ ਵਨ ਟਵੈਂਟੀ ਰਿਫਰੈਸ਼ ਰੇਟ ਹੈਗਾ ਇਹਦੀ ਜਿਹੜੀ ਡਿਸਪਲੇ ਦਾ ਬੈਜਲ ਲੈਸ ਆ ਅਤੇ ਥ੍ਰੀ ਥ੍ਰੀ ਥਾਊਜ਼ੈਂਡ ਨੀਟਸ ਇਹਦੀ ਬਰਾਈਟਨੈਸ ਆ ਜੋ ਕਿ ਬਹੁਤ ਹੀ ਬਰਾਈਟਡ ਡਿਸਪਲੇ ਆ ਇਹ ਵਾਲੇ ਫੋਨ ਦੀ ਪਰਫੋਰਮੈਂਸ ਕੈਮਰਾ ਜੋ ਵੀ ਆ ਬਹੁਤ ਵਧੀਆ ਆ